ਹਾਂਜੀ ਸਤਿ ਸ਼੍ਰੀ ਅਕਾਲ ਸਰ ਠੀਕ ਹੈ ਜੀ ਤੁਸੀਂ ਸੁਣਾਓ ਸ ਸਰ ਆਪਣਾ ਇਸ ਵਾਰੀ ਕਿਵੇਂ ਤੁਹਾਡੇ ਵੱਲ ਐਡਮਿਸ਼ਨ ਤੁਹਾਡੀ ਸਟਰੀਮ 'ਚ ਡਿਪਾਰਟਮੈਂਟ ਹਾਂਜੀ ਹਾਂਜੀ

ਹਾਂਜੀ

ਠੀਕ ਹੈ ਜੀ ਹਮ ਜੀ ਹਾਂਜੀ ਠੀਕ ਹੈ ਸਰ ਸਰ ਸਾਡੇ ਵੀ ਸੀ ਐੱਸ ਈ ਟ੍ਰੇਡ 'ਚ ਸਭ ਤੋਂ ਵੱਧ ਐਡਮੀਸ਼ਨਜ਼ ਹੋ ਰਹੀਆਂ ਨੇ ਅਤੇ ਜਿਵੇਂ ਬੱਚਿਆਂ ਨੂੰ ਵੀ ਪਤਾ ਏ ਕਿ ਇਹ ਸਟਰੀਮ ਨਾਲ ਜੋਬ ਜ਼ਿਆਦਾ ਹੈ ਨਾ ਮਿਲਣ ਦੇ ਚਾਨਸਿਸ ਨੇ ਅਤੇ ਇਹ ਹੀ ਸਟਰੀਮ ਜਿਹੜੀ ਆ ਸਭ ਤੋਂ ਜ਼ਿਆਦਾ ਇਹਦੇ 'ਚ ਐਡਮੀਸ਼ਨਸ ਹੋ ਰਹੀਆਂ ਮਕੈਨੀਕਲ ਵੀ ਪਿੱਛੇ ਹਾਂਜੀ ਹਾਂਜੀ ਓਕੇ